ਮੈਨੂੰ ਵਕੀਲ ਪੁਲਿਸ ਪੰਚਾਇਤ ਜਾਂ ਤਹਿਸੀਲ ਦਫਤਰ ਦੇ ਲੋਕਾਂ ਵਰਗੇ ਕਾਨੂੰਨੀ ਅਧਿਕਾਰੀਆਂ ਕਾਰਨ ਕੋਈ ਮੁਸ਼ਕਿਲ ਨਹੀਂ ਆਈ ਅਤੇ ਨਾ ਹੀ ਮੈਂ ਭ੍ਰਿਸ਼ਟਾਚਾਰ ਦਾ ਕਦੇ ਅਨੁਰੋਧ ਕੀਤਾ ਹੈ ਅਤੇ ਵਕੀਲ ਜਿਹੜਾ ਆ ਉਹਦੇ ਨਾਲ ਕੀ ਕੇਸ ਮਾਣਹਾਨੀ ਦਾ ਹੋਣ ਕਰਕੇ ਜ਼ਿਆਦਾ ਤਕਲੀਫ ਨਹੀਂ ਅਤੇ ਉਹਨਾਂ ਨੇ ਬਿਲਕੁਲ ਸੱਚਾਈ ਦੇ ਰਸਤੇ ਚੱਲਦੇ ਹੋਏ ਮੈਨੂੰ ਨਿਆਂਏ ਦਵਾਇਆ ਸੀਗਾ ਅਤੇ ਜਿਹੜੀ ਪੁਲਿਸ ਵਾ ਉਹ ਵੀ ਜੇ ਰਸਤੇ 'ਚ ਮਿਲ ਜਾਂਦੀ ਸੀ ਜੇ ਸਾਡੇ ਕੋਲ ਪੂਰੇ ਸਮਾਨ ਹੈ ਜਾਂ ਕਿਸੇ ਅਸੀਂ ਨਿਰਦੋਸ਼ ਹਾਂ ਸਾਨੂੰ ਕੁਛ ਨਹੀਂ ਕਹਿੰਦੀ ਜੇ ਤੁਸੀਂ ਜਾ ਰਹੇ ਹੋ ਜੇ ਹੈਲਮਟ ਨਹੀਂ ਪਾਇਆ ਤਾਂ ਤੁਸੀਂ ਤੁਹਾਡੇ ਦਿਲ 'ਚ ਡਰ ਹੋਵੇਗਾ ਤੁਸੀਂ ਆਪਣੇ ਪੂਰੇ ਹੈਲਮਟ ਲੈ ਕੇ ਗੱਡੀ ਦੇ ਕਾਗਜ਼ ਪੂਰੇ ਰੱਖੋ ਤਾਂ ਤੁਹਾਨੂੰ ਕੋਈ ਅਧਿਕਾਰੀ ਜਿਹੜੇ ਆ ਆਪਣੇ ਨਹੀਂ ਤਕਲੀਫ ਆਉਣ ਦਿੰਦੇ ਅਤੇ ਤੁਹਾਡੇ ਨਾਲ ਕੋਆਪਰੇਟ ਕਰਦੇ ਹਨ ਅਤੇ ਭ੍ਰਿਸ਼ਟਾਚਾਰ ਦਾ ਅਨੁਭਵ ਕਦੇ ਨਹੀਂ ਕੀਤਾ ਅਤੇ ਭ੍ਰਿਸ਼ਟਾਚਾਰ ਦੇ ਸਾਡੇ ਇੱਧਰ ਇਲਾਕੇ ਦੇ ਵਿੱਚ ਭ੍ਰਿਸ਼ਟਾਚਾਰ ਤਾਂ ਹੈ ਵੀ ਨਹੀਂ ਜ਼ਿਆਦਾਤਰ